ਹਾਂਜੀ ਭਾਰਤੀ ਆਵਾਜਾਈ ਪ੍ਰਣਾਲੀ ਕੋਈ ਬਹੁਤੀ ਵਧੀਆ ਤਾਂ ਹੈ ਨਹੀਂ ਜੀ ਜਿਵੇਂ ਕਿ ਇਸ ਵਿੱਚ ਬੱਸਾਂ ਟਰੇਨਾਂ ਹਵਾਈ ਯਾਤਰਾ ਆਦਿ ਆਉਂਦੀਆਂ ਹਨ ਪਹਿਲਾਂ ਆਪਾਂ ਗੱਲ ਕਰੀਏ ਜੀ ਬੱਸਾਂ ਦੀ ਇਹ ਪਬਲਿਕ ਟਰਾਂਸਪੋਰਟ ਹੈ ਜੀ ਅਤੇ ਇਹਨੂੰ ਹਰ ਕੋਈ ਯੂਜ਼ ਕਰ ਸਕਦਾ ਜੀ ਠੀਕ ਹੈ ਯਾਤਰੀਆਂ ਨੂੰ ਆਉਣ ਵਾਲੀਆਂ ਇਹਦੇ 'ਚ ਜਿਹੜੀਆਂ ਪਰੇਸ਼ਾਨੀਆਂ ਏ ਜੀ ਜ਼ਿਆਦਾਤਰ ਜੀ ਸੀਟਸ ਹੈ ਜਿਵੇਂ ਉਹ ਕੰਫਰਟੇਬਲ ਨਹੀਂ ਹੁੰਦੀਆਂ ਅਤੇ ਲੋਕਾਂ ਨੂੰ ਬੈਠਣ ਉੱਠਣ 'ਚ ਬਹੁਤ ਤਕਲੀਫ ਆਉਂਦੀ ਹੈ ਅਤੇ ਬੱਸਾਂ ਵਿੱਚ ਹੀ ਲੰਬਾ ਸਫਰ ਨਹੀਂ ਕਰਿਆ ਜਾ ਸਕਦਾ ਕਿਉਂਕਿ ਇਸ ਵਿੱਚ ਇਕੱਲਾ ਹੀ ਬੈਠਣ ਦਾ ਪ੍ਰਬੰਧ ਹੁੰਦਾ ਏ ਨਾ ਕਿ ਸੌਣ ਪੈਣ ਦਾ ਹੁੰਦਾ ਏ ਅਤੇ ਨਾ ਹੀ ਇਸ ਵਿੱਚ ਕੋਈ ਖਾਣ ਦਾ ਪ੍ਰਬੰਧ ਹੁੰਦਾ ਏ ਅਤੇ ਹੁਣ ਆਪਾਂ ਗੱਲ ਕਰਦੇ ਜਿਵੇਂ ਕਿ ਟਰੇਨਾਂ ਦੀ ਟਰੇਨਾਂ 'ਚ ਥੋੜ੍ਹਾ ਜਿਹਾ ਸਫਰ ਕਰਨਾ ਸੌਖਾ ਹੋ ਜਾਂਦਾ ਏ ਜਿਵੇਂ ਕਿ ਉਸ ਵਿੱਚ ਪੈਣ ਦਾ ਵੀ ਪ੍ਰਬੰਧ ਹੁੰਦਾ ਏ ਅਤੇ ਖਾਣ ਪੀਣ ਦਾ ਅਰੇਂਜਮੈਂਟ ਵੀ ਵਿੱਚ ਹੀ ਕੀਤਾ ਜਾਂਦਾ ਹੈ ਅਤੇ ਇਹ ਨੂੰ ਬ ਹਰ ਕੋਈ ਅਫੋਡ ਕਰ ਸਕਦਾ ਏ ਇਹ ਬਹੁਤੀ ਜ਼ਿਆਦਾ ਕੋਈ ਮਹਿੰਗੀ ਨਹੀਂ ਹੁੰਦੀ ਜੀ ਦਿਨ ਪਰ ਦਿਨ ਆਵਾਜਾਈ ਦੇ ਸਾਧਨ ਵੱਧ ਹੀ ਰਹੇ ਐਂ ਨਾ ਕਿ ਘੱਟ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ